ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਸਿੰਘ ਪਠਾਣੀਆਂ ਹੈ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਮੈਂ ਪਠਾਨਕੋਟ ਵਿੱਚ ਰਹਿੰਦਾ ਹਾਂ ਜਿਵੇਂ ਕਿ ਇਹਦਾ ਪ੍ਰਸ਼ਨ ਹੈ ਕਿ ਪੰਜਾਬ ਵਿੱਚ ਈਕੋ ਟੂਰਿਜ਼ਮ ਦੇ ਕੁਝ ਮੌਕੇ ਕੀ ਹਨ ਅਗਰ ਮੈਂ ਉਸਦਾ ਜਵਾਬ ਦੇਵਾਂ ਤਾਂ ਮੇਰੇ ਮੁਤਾਬਿਕ ਜਿੱਦਾਂ ਕਿ ਰਾਜ ਆਪਣੇ ਜੀਵਨ ਸੱਭਿਆਚਾਰ ਸੁਆਦੀ ਪਕਵਾਨ ਅਧਿਆਤਕਮਿਕ ਮਹੱਤਤਾ ਅਤੇ ਇਤਿਹਾਸਿਕ ਪ੍ਰਸੰਗਕਿਤਾ ਲਈ ਜਾਣਿਆ ਜਾਂਦਾ ਹੈ ਪੰਜਾਬ ਦੇ ਮੁੱਖ ਆਕਰਸ਼ਣ ਹਨ ਜਿਵੇਂ ਕਿ ਹਰਮਿੰਦਰ ਸਾਹਿਬ ਜਲ੍ਹਿਆਂਵਾਲਾ ਬਾਗ ਜਿੱਥੇ ਕਾਂਡ ਹੋਇਆ ਸੀ ਵਾਹਗਾ ਬੋਡਰ ਜਿੱਥੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਦੋਨੋਂ ਆਪਣੀ ਪ੍ਰਯਤਨ ਕਰਦੇ ਹਨ ਸਿਪਾਹੀ ਅਤੇ ਹੋਰ ਬਹੁਤ ਕੁਝ ਜਿੱਦਾਂ ਕਿ ਗੋਲਡਨ ਟੈਂਪਲ ਅੰਮ੍ਰਿਤਸਰ ਵਿਖੇ ਆ ਅਗਰ ਆਪਾਂ ਸੈਲਾਨੀ ਵਾਤਾਵਰਨ ਦੀ ਸੁਰੱਖਿਆ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ ਤਾਂ ਆਪਾਂ ਘੱਟ ਤੋਂ ਘੱਟ ਪੋਲਊਸ਼ਨ ਨੂੰ ਕਰੀਏ ਆਪਾਂ ਜਿੱਦਾਂ ਕਿ ਅੱਜ ਕੱਲ੍ਹ ਸੀ ਐਨ ਜੀ ਵਾਲੀਆਂ ਕਾਰਾਂ ਚੱਲ ਪਈਆਂ ਹਨ ਈ ਰਿਕਸ਼ਾ ਹੋ ਗਿਆ ਹੈ ਉਹਨਾਂ ਦਾ ਵਰਤੋਂ ਕਰੀਏ ਸੀ ਐਨ ਜੀ ਵਾਲੀਆਂ ਗੱਡੀਆਂ ਯੂਜ ਕਰੀਏ ਤਾਂ ਹੀ ਆਪਾਂ ਆਪਣਾ ਵਾਤਾਵਰਣ ਨੂੰ ਠੀਕ ਰੱਖ ਸਕਦੇ ਹਨ ਜਿੱਦਾਂ ਕਿ ਸਾਡੇ ਘਰਾਂ ਵਿੱਚ ਫ੍ਰਿਜਸ ਲੱਗੇ ਹੁੰਦੇ ਹਨ ਜਿਸ ਵਿੱਚੋਂ ਕਾਰਬਨ ਮੌਨੋਅਕਸਾਈਡ ਗੈਸ ਨਿਕਲਦੀ ਹੈ ਜੋ ਸਾਡੇ ਗ੍ਰੀਨ ਹਾਊਸ ਇਫੈਕਟ ਨੂੰ ਬਣਾਉਂਦੀ ਹੈ ਜਿੱਦਾਂ ਕਿ ਸਾਨੂੰ ਪਤਾ ਹੈ ਗ੍ਰੀਨ ਹਾਊਸ ਇਫੈਕਟ ਸਾਡੇ ਵਾ ਸਾਡੇ ਇਨਵਾਇਰਮੈਂਟ ਨੂੰ ਜਿੱਦਾਂ ਕਿ ਗਲੋਬਲ ਵਾਰਮਿੰਗ ਫੈਲ ਰਿਹਾ ਹੈ ਜਿਹਦੇ ਕਾਰਨ ਵਾਤਾਵਰਨ ਕਾਫ਼ੀ ਜ਼ਿਆਦਾ ਗਰਮ ਹੋ ਰਿਹਾ ਜਿਸ ਕਾਰਨ ਓਜੋਨ ਹੋਲ ਹੋ ਗਿਆ ਹੈ ਇਹਨਾਂ ਸਾਰੀ ਚੀਜ਼ਾਂ ਲਈ ਆਪਾਂ ਅਗਰ ਦੇਖ ਕਰੀਏ ਤਾਂ ਆਪਾਂ ਇਹਨਾਂ ਨੂੰ ਸਹੀ ਸੁਰੱਖਿਅਤ ਕਰ ਸਕਦੇ ਹਾਂ ਧੰਨਵਾਦ